ਜਿਵੇਂ ਆਪਾਂ ਪਹਿਲਾਂ ਟੈਕਨੋਲਜੀ ਤੋਂ ਬਿਨਾਂ ਦੇਖਦੇ ਸੀ ਵਪਾਰ ਲੋਕਲ ਵਪਾਰ ਹੁੰਦੇ ਸੀਗੇ ਬਜ਼ਾਰਾਂ ਦੇ ਵਿੱਚ ਇੱਕ ਦੂਜੇ ਤੋਂ ਚੀਜ਼ ਖਰੀਦੀ ਵੇਚੀ ਜਾਂਦੀ ਸੀਗੀ ਅਤੇ ਪਰ ਉੱਥੇ ਆਪਣੀ ਜਿਹੜੀ ਚੋਇਸ ਸੀਗੀ ਵਾਈਡ ਜਿਵੇਂ ਆਪਾਂ ਕਹਿ ਦੇਈਏ ਬਹੁਤ ਵੱਡਾ ਬਜ਼ਾਰ ਉਹ ਨਹੀਂ ਮਿਲ ਪਾਉਂਦਾ ਸੀ ਆਪਾਂ ਨੂੰ ਲੋਕਲ ਕਰਕੇ ਤਾਂ ਲੋਕਾਂ ਦੀ ਉਹ ਹੀ ਚੀਜ਼ ਲੈਣੀ ਪੈਂਦੀ ਸੀ ਲੋਕਾਂ ਨੂੰ ਮਜ਼ਬੂਰੀ 'ਚ ਜਿਹੜੀ ਬਜ਼ਾਰ 'ਚ ਹੁੰਦੀ ਸੀਗੀ ਚਾਹੇ ਉਹ ਮਾੜੀ ਆ ਚਾਹੇ ਉਹ ਚੰਗੀ ਆ ਉਹਨਾਂ ਨੂੰ ਖਰੀਦਣੀ ਪੈਂਦੀ ਸੀ ਲੋਕਲ ਕਰਕੇ ਜਾਂ ਆਪਣੇ ਦੇਸ਼ ਦੇ ਥਰੂ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਲੈ ਸਕਦੇ ਸੀ ਆਪਾਂ ਪਰ ਹੁਣ ਆਪਣੇ ਕੋਲ ਤਕਨੋਲਜੀ ਦੇ ਜ਼ਰੀਏ ਬਹੁਤ ਵੱਡਾ ਬਜ਼ਾਰ ਹੈ ਪੂਰੀ ਦੁਨੀਆ ਦੇ ਵਿੱਚ ਪੂਰਾ ਕੰਪੀਟੀਸ਼ਨ ਆ ਆਪਾਂ ਜ਼ਰੂਰੀ ਨਹੀਂ ਕਿ ਕੋਈ ਵੀ ਜਿਹੜੇ ਵੀ ਆਪਾਂ ਮਜ਼ਬੂਰ ਹੋ ਕੇ ਕਿਸੇ ਸਟੇਟ ਦੀ ਚੀਜ਼ ਲੈਣੀ ਆ ਆਪਾਂ ਹੁਣ ਪੂਰੀ ਦੁਨੀਆ ਦੇ ਵਿੱਚੋਂ ਚੈੱਕ ਕਰਕੇ ਫਰਾਈ ਚੈੱਕ ਕਰਕੇ ਰੇਟ ਚੈੱਕ ਕਰਕੇ ਪੂਰੀ ਦੁਨੀਆ ਦੇ ਵਿੱਚੋਂ ਚੀਜ਼ ਮੰਗਵਾ ਸਕਦੇ ਹਾਂ ਨਵੀਂ ਤੋਂ ਨਵੀਂ ਤਕਨਾਲੋਜੀ ਦੀ ਜ਼ਰੂਰੀ ਨਹੀਂ ਕਿ ਆਪਾਂ ਉਸ 'ਤੇ ਪਰਾਣੀ ਚੀਜ਼ 'ਤੇ ਹੀ ਡਿਪੈਂਡ ਰਹੀਏ ਇਹ ਬਹੁਤ ਟੈਕਨੋਲੋਜੀ ਨੇ ਭੂਮਿਕਾ ਨਿਭਾਈ ਇਹਦੇ ਵਿੱਚ ਖਰੀਦਦਾਰੀ ਦੇ ਵਿੱਚ ਔਨਲਾਈਨ ਹੁਣ ਆਪਾਂ ਨੂੰ ਪੈਸੇ ਚੱਕਣ ਦੀ ਲੋੜ ਨਹੀਂ ਆਪਾਂ ਅੱਗੇ ਕੈਸ਼ ਜੇਬਾਂ 'ਚ ਪਾ ਕੇ ਤੁਰਦੇ ਸੀ ਉਹਦੀ ਲੁੱਟ ਕਸੁੱਟ ਹੋ ਜਾਂਦੀ ਸੀ ਚੋਰ ਖੋਹ ਕੇ ਲੈ ਜਾਂਦੇ ਸੀ ਬੈਂਕਾਂ ਦੇ ਵਿੱਚ ਕੋਈ ਪੈਸੇ ਭਰਨ ਜਾਂਦਾ ਸੀ ਕਿਉਂਕਿ ਜ਼ਿੰਮੀਦਾਰ ਜਿਵੇਂ ਕਿਸ਼ਤ ਭਰਨ ਵੱਗ ਗਿਆ ਜਾਂ ਕੋਈ ਆੜਤੀਆ ਲਿਮਟ ਭਰਨ ਵੱਗ ਗਿਆ ਤਾਂ ਉਹਦੇ ਪੈਸੇ ਰਸਤੇ ਦੇ ਵਿੱਚ ਹੀ ਖੋਹ ਲਏ ਜਾਂਦੇ ਸੀਗੇ ਪਰ ਹੁਣ ਟਕਨੋਲੋਜੀ ਦੇ ਜ਼ਰੀਏ ਇੱਕ ਮਿੰਟ ਦੇ ਵਿੱਚ ਹੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ ਆਪਾਂ ਨੂੰ ਕੈਸ਼ ਚੱਕਣ ਦੀ ਲੋੜ ਨਹੀਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਟਕਨੋਲਜੀ ਨੇ ਵਾਪਰ ਖੇਤਰ ਦੇ ਵਿੱਚ ਵੀ ਬਹੁਤ ਲੋਕਾਂ ਨੂੰ ਫੈਸਿਲਿਟੀ ਦਿੱਤੀ ਹੈ ਤਾਂ ਬਹੁਤ ਵਧੀਆ ਟੈਕਨੋਲੋਜੀ ਹੈ